ਹਰਭਜਨ ਮਾਨ ਮੈਨੂੰ ਬਹੁਤ ਪਸੰਦ ਹੈ ਗਾਇਕ ਕਲਾਕਾਰ ਹੈ ਜਿਹੜਾ ਹੈ ਨਾ ਉਹ ਬਹੁਤ ਸੋਹਣੇ ਗਾਣੇ ਗਾਉਂਦਾ ਫਿਲਮਾਂ ਵੀ ਬਣਾਉਂਦਾ ਅਤੇ ਉਹਦੇ ਗਾਣੇ ਆਪਾਂ ਪਰਿਵਾਰ ਵਿੱਚ ਬੈਠ ਕੇ ਵੀ ਸੁਣ ਸਕਦੇ ਹਾਂ ਉਹਦੀਆਂ ਫਿਲਮਾਂ ਵੀ ਆਪਾਂ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ ਅਤੇ ਬਹੁਤ ਵਧੀਆ ਹੈ ਨਾ ਗਾਣੇ ਗਾਉਂਦਾ ਉਹ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਇੰਸਟਾਗ੍ਰਾਮ 'ਤੇ ਉਹਦੀਆਂ ਰੀਲਾਂ ਮੂਵੀਆਂ ਆਉਂਦੀਆਂ ਨੇ ਬੱਚਾ ਬੱਚਾ ਵੀ ਉਹਦੀਆਂ ਫਿਲਮਾਂ ਦੇਖ ਸਕਦਾ ਹੈਗਾ ਹੈ ਨਾ ਅਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਅੱਜ ਕੱਲ੍ਹ ਜੋ ਮਾਹੌਲ ਹੈ ਉਹਦੇ ਮੁਤਾਬਿਕ ਉਹਦੀਆਂ ਫਿਲਮਾਂ ਅਤੇ ਗਾਣੇ ਬਹੁਤ ਵਧੀਆ ਹੁੰਦੇ ਹਨ ਭੈਣ ਭਰਾਵਾਂ ਦੇ ਮਾਂ ਬਾਪ ਦੇ ਬਹੁਤ ਵਧੀਆ ਗਾਣੇ ਗਾਉਂਦਾ ਉਹ ਹੈ ਨਾ ਸਾਨੂੰ ਬਹੁਤ ਜ਼ਿਆਦਾ ਪਸੰਦ ਹੈ ਪੰਜਾਬੀ ਕਲਾਕਾਰ ਉਹ ਹਰਭਜਨ ਮਾਨ ਉਹਦੀਆਂ ਫਿਲਮਾਂ ਵੀ ਬਹੁਤ ਜ਼ਿਆਦਾ ਮੈਨੂੰ ਪਸੰਦ ਨੇ ਅਤੇ ਕੋਈ ਸ਼ੋਰ ਸ਼ਰਾਬੇ ਵਾਲੀ ਉਹਦੀ ਕੋਈ ਫਿਲਮ ਜਾਂ ਗਾਣਾ ਨਹੀਂ ਹੁੰਦਾ ਅੱਜ ਕਲ੍ਹ ਜਿਵੇਂ ਮਾਹੌਲ ਅੱਜ ਕੱਲ੍ਹ ਹੈ ਨਾ ਬੱਚੇ ਗਾਣੇ ਦੇਖ ਕੇ ਵਿਗੜਦੇ ਨੇ ਪਰ ਜਿਹੜੇ ਉਹਦੇ ਗਾਣੇ ਨੇ ਉਹ ਸਾਨੂੰ ਸਿੱਖਿਆ ਹੀ ਦਿੰਦੇ ਨੇ ਭੈਣ ਭਰਾਵਾਂ ਦੇ ਅਤੇ ਮਾਤਾ ਪਿਤਾ ਦੇ ਬਹੁਤ ਗਾਣੇ ਗਾਉਂਦਾ ਉਹ ਹਰਭਜਨ ਮਾਨ ਇਸ ਕਰਕੇ ਸਾਨੂੰ ਉਹਦੇ ਗਾਣੇ ਅਤੇ ਫਿਲਮਾਂ ਬਹੁਤ ਜ਼ਿਆਦਾ ਪਸੰਦ ਨੇ ਅਤੇ ਹਰ ਇੱਕ ਪਰਿਵਾਰਕ ਮੈਂਬਰ ਉਹਦੇ ਗਾਣੇ ਅਤੇ ਫਿਲਮਾਂ ਦੇਖ ਸਕਦਾ ਹੈਗਾ ਅਤੇ ਸਾਨੂੰ ਇਸ ਤਰ੍ਹਾਂ ਦੇ ਹੀ ਗਾਣੇ ਸੁਣਨੇ ਚਾਹੀਦੇ ਹਨ ਜੋ ਕਿ ਅੱਜ ਕੱਲ੍ਹ ਦਿਮਾਗ ਖਰਾਬ ਕਰਨ ਵਾਲੇ ਕੋਈ ਵੀ ਇਹੋ ਜਿਹੀ ਫਿਲਮ ਜਾਂ ਗਾਣਾ ਸਾਨੂੰ ਨਹੀਂ ਸੁਣਨਾ ਚਾਹੀਦਾ ਅਤੇ ਸਾਨੂੰ ਹਰਭਜਨ ਮਾਨ 'ਤੇ ਬਹੁਤ ਮਾਣ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਇਸੇ ਤਰ੍ਹਾਂ ਹੀ ਵਿਚਾਰਾ ਉਹ ਗਾਉਂਦਾ ਰਹੇ ਧੰਨਵਾਦ ਜੀ